ਮੈਂ ਥੋੜ੍ਹੇ ਦਿਨ ਪਹਿਲਾਂ ਐਮਾਜੋਨ ਸਕਰੋਲ ਕਰ ਰਹੀ ਸੀਗੀ ਅਤੇ ਉੱਥੇ ਨਾ ਮੈਨੂੰ ਇੱਕ ਬਹੁਤ ਸੋਹਣੀ ਡਰੈੱਸ ਦਿਖੀ ਉਹਦਾ ਕਲਰ ਵਗੈਰਾ ਬਹੁਤ ਸੋਹਣਾ ਸੀਗਾ ਅਤੇ ਜਦ ਨਾ ਉਹ ਡਰੈੱਸ ਦੇਖੀ ਨਾ ਮੇਰੇ ਮਨ 'ਚ ਆਇਆ ਕਿ ਮੈਂ ਉਸੇ ਟਾਇਮ ਉਹਨੂੰ ਔਡਰ ਕਰ ਲਵਾਂ ਫਿਰ ਮੈਂ ਉਹਦਾ ਰੇਟ ਦੇਖਿਆ ਅਤੇ ਰੇਟ ਵੀ ਉਹਦਾ ਇੰਨਾਂ ਜ਼ਿਆਦਾ ਘੱਟ ਸੀਗਾ ਨਾ ਕਿ ਮੈਂ ਉਹਨੂੰ ਉਸੇ ਟਾਇਮ ਔਡਰ ਕਰ ਲਿਆ ਉਸ ਤੋਂ ਬਾਅਦ ਜਿੰਨੀ ਇਕਸਾਇਟਮੈਂਟ ਮੈਨੂੰ ਉਸ ਪਾਰਸਲ ਦੀ ਹੋਈ ਨਾ ਕਿ ਵੀ ਕਦ ਆਵੇ ਕਦ ਆਵੇ ਫਿਰ ਜਿਸ ਦਿਨ ਉਹ ਪਾਰਸਲ ਆਇਆ ਮੈਂ ਉਹਨੂੰ ਫਟਾਫਟ ਖੋਲ੍ਹਿਆ ਅਤੇ ਮੈਂ ਦੇਖ ਕੇ ਨਾ ਪੂਰੀ ਦੀ ਪੂਰੀ ਸ਼ੌਕ ਦੇ ਵਿੱਚ ਰਹਿ ਗਈ ਜਦ ਉਹ ਮੈਂ ਡਰੈਸ ਦੇਖੀ ਉਹ ਹੈਗੀ ਓ ਬਹੁਤ ਜ਼ਿਆਦਾ ਸੋਹਣੀ ਸੀਗੀ ਮੈਨੂੰ ਉਹਦਾ ਕਲਰ ਇੰਨਾਂ ਜ਼ਿਆਦਾ ਵਧੀਆ ਲੱਗਿਆ ਉਸ ਤੋਂ ਵੀ ਵਧੀਆ ਗੱਲ ਉਹਦਾ ਕੱਪੜਾ ਇੰਨਾਂ ਜ਼ਿਆਦਾ ਮੁਲਾਇਮ ਅੰਦਰ ਤੋਂ ਪਾਉਣ 'ਤੇ ਉਹਦਾ ਪਤਾ ਹੀ ਨਹੀਂ ਲੱਗਿਆ ਕਿ ਮੈਂ ਕੁਛ ਪਾਇਆ ਵੀ ਹੋਇਆ ਉਸ ਤੋਂ ਬਾਅਦ ਮੈਂ ਜਦ ਸਾਰਿਆਂ ਨੂੰ ਆਹ ਡਰੈਂਸ ਦਿਖਾਈ ਨਾ ਕਿਸੇ ਨੇ ਵੀ ਮੇਰਾ ਯਕੀਨ ਨਹੀਂ ਕੀਤਾ ਕਿ ਆਹ ਡਰੈਂਸ ਇੰਨੇ ਘੱਟ ਪਰਾਇਜ ਦੇ ਵਿੱਚ ਮਿਲ ਸਕਦੀ ਹੈ ਕਿਸੇ ਨੂੰ ਯਕੀਨ ਨਹੀਂ ਆਇਆ ਜਦ ਤੱਕ ਮੈਂ ਆਪਣਾ ਫ਼ੋਨ ਖੋਲ੍ਹ ਕੇ ਨਹੀਂ ਦਿਖਾਇਆ ਕਿ ਮੈਂ ਸੱਚੀ ਇੰਨੇ ਪੈਸਿਆਂ 'ਚ ਆਹ ਡਰੈਸ ਮੰਗਵਾਈ ਆ ਅਤੇ ਜਦ ਮੈਂ ਉਹ ਡਰੈਸ ਪਾਈ ਨਾ ਉਹ ਮੈਨੂੰ ਸੂਟ ਵੀ ਬਹੁਤ ਜ਼ਿਆਦਾ ਕਰ ਰਹੀ ਸੀਗੀ ਉਹਦੀ ਫੀਟਿੰਗ ਬਹੁਤ ਜ਼ਿਆਦਾ ਵਧੀਆ ਸੀਗੀ ਅਤੇ ਆਹ ਏ ਨਾ ਡਰੈਸ ਨੂੰ ਮੈਂ ਕਿਸੇ ਵੀ ਤਰੀਕੇ ਦੀ ਜੂਲਰੀ ਨਾਲ ਮੈਚ ਕੀਤਾ ਤਾਂ ਉਹ ਮੈਚ ਵੀ ਹੋ ਗਈ ਸੈਂਡਲ ਅਤੇ ਬੂਟ ਨਾਲ ਦੋਨਾਂ ਨਾਲ ਪਾ ਕੇ ਦੇਖੀ ਦੋਨਾਂ ਨਾਲ ਹੀ ਬਹੁਤ ਜ਼ਿਆਦਾ ਵਧੀਆ ਲੱਗ ਰਹੀ ਸੀਗੀ ਅਤੇ ਮੈਂ ਆਹ ਡਰੈਸ ਹੈ ਨਾ ਮੇਰਾ ਫਸਟ ਐਕਸਪੀਰੀਅਸ ਸੀਗਾ ਐਮਾਜੋਨ ਤੋਂ ਅਤੇ ਮੇਰਾ ਬਹੁਤ ਹੀ ਜ਼ਿਆਦਾ ਵਧੀਆ ਐਕਸਪੀਰੀਐਂਸ ਰਿਹਾ